ਸਾਡੇ ਜ਼ਿਲ੍ਹੇ ਵਿੱਚ ਕਾਫ਼ੀ ਪੂਜਨੀਏ ਥਾਵਾਂ ਹਨ ਜਿੱਥੇ ਲੋਕ ਆਪਣੀਆਂ ਸ਼ਰਧਾ ਭਾਵਨਾ ਨਾਲ ਜਾਂਦੇ ਹਨ ਅਤੇ ਉੱਥੇ ਆਦਰ ਮਾਣ ਕਰਕੇ ਮੱਥਾ ਟੇਕਦੇ ਹਨ ਸਿਰ ਝੁਕਾਉਂਦੇ ਹਨ ਹਿੰਦੂ ਵੀਰ ਆਪਣੇ ਕਾਲੀ ਮਾਤਾ ਮੰਦਰ ਜਾਂਦੇ ਹਨ ਅਤੇ ਸਿੱਖ ਲੋਕ ਦੁੱਖ ਨਿਵਾਰਨ ਸਾਹਿਬ ਜਾਂਦੇ ਹਨ ਪਰ ਸਾਰੇ ਇੱਕ ਦੂਜੇ ਦਾ ਆਦਰ ਕਰਦੇ ਨੇ ਸਾਡਾ ਭਾਈਚਾਰਾ ਬਹੁਤ ਬਣਿਆ ਹੋਇਆ ਸਾਡੇ ਇੱਥੇ ਵਿਸਾਖੀ ਦਾ ਤਿਉਹਾਰ ਜਿਹੜਾ ਦੁੱਖ ਨਿਵਾਰਨ ਸਾਹਿਬ ਅਤੇ ਬਸੰਤ ਪੰਚਮੀ ਵੀ ਤਿਉਹਾਰ ਨਹੀਂ ਹੈ ਉਹ ਦਿਨ ਹੈ ਪਰ ਉਹ ਵੀ ਬਹੁਤ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ ਅਤੇ ਜਿਹੜਾ ਵਿਸਾਖੀ ਦਾ ਤਿਉਹਾਰ ਆ ਉੱਥੇ ਜੋੜ ਮੇਲਾ ਸੱਜਦਾ ਹੈ ਕਾਲੀ ਮਾਤਾ ਮੰਦਰ ਵਾਲੇ ਵੀ ਉੱਥੇ ਆਉਂਦੇ ਹਨ ਅਤੇ ਸਾਡੇ ਵਾਲੇ ਵੀ ਕਈ ਵਾਰੀ ਕਾਲੀ ਮਾਤਾ ਮੰਦਰ ਜਾਂਦੇ ਹਨ ਸੇਵਾ ਪ੍ਰਦਾਨ ਕਰਦੇ ਹਨ ਬੇਸ਼ੱਕ ਉਹ ਨਹੀਂ ਮੰਨਦੇ ਪਰ ਉਹਨਾਂ ਨੂੰ ਆਦਰ ਕਰਨ ਦਾ ਹੁਕਮ ਹੈ ਮਹਾਰਾਜ ਵੱਲੋਂ ਅਤੇ ਉਹ ਆਦਰ ਵੀ ਕਰਦੇ ਹਨ ਅਤੇ ਇਹਦੇ ਨਾਲ ਸਾਡਾ ਭਾਈਚਾਰਾ ਬਣਿਆ ਰਹਿੰਦਾ ਹੈ ਅਸੀਂ ਸਾਰਿਆਂ ਨੂੰ ਇੱਕ ਮਿੱਕ ਹੋ ਕੇ ਮਿਲਦੇ ਹਾਂ ਅਤੇ ਇੱਕ ਇੱਕ ਇੱਕ ਮਿੱਕ ਹੋ ਕੇ ਰਹਿੰਦੇ ਹਾਂ ਕੋਈ ਇੱਥੇ ਲੜਾਈ ਝਗੜੇ ਵਾਲੀ ਗੱਲ ਨਹੀਂ ਸਾਰੇ ਮਿਲ ਜੁਲ ਕੇ ਰਹਿੰਦੇ ਕਿਉਂਕਿ ਅਸੀਂ ਬਿਨਾਂ ਜਾਤ ਪਾਤ ਤੋਂ ਸਾਰਿਆਂ ਦਾ ਆਦਰ ਕਰਦੇ ਹਾਂ ਭਾਵੇਂ ਕੋਈ ਛੋਟਾ ਭਾਵੇਂ ਕੋਈ ਵੱਡਾ ਸਭ ਨੂੰ ਆਉਣ ਦੀ ਆਗਿਆ ਹੈ ਅਤੇ ਸਾਰੇ ਖੁਸ਼ੀ ਖੁਸ਼ੀ ਆਉਂਦੇ ਹਨ ਅਤੇ ਖੁਸ਼ੀ ਖੁਸ਼ੀ ਜਾਂਦੇ ਹਨ ਇਸ ਕਰਕੇ ਸਾਡੇ ਜ਼ਿਲ੍ਹੇ 'ਚ ਕੋਈ ਲੜਾਈ ਝੜਾਈ ਧਰਮਾਂ ਪਿੱਛੇ ਲੜਾਈ ਨਹੀਂ ਹੁੰਦੀ ਸਾਰੇ ਮਿਲ ਜੁਲ ਕੇ ਰਹਿੰਦੇ ਹਨ ਅਤੇ ਇਹ ਭਾਈਚਾਰਾ ਬਣਿਆ ਹੈ ਅਤੇ ਬਣਿਆ ਰਹੇਗਾ